ਪੰਜਾਬ ਵਿੱਚ ਖੇਡ ਖੇਤਰਾਂ ਖੇਡਾਂ ਨਾਲ ਸੰਬੰਧਿਤ ਸੱਟੇਵਾਜੀ ਜਾਂ ਜੂਏ ਦੇ ਮੁੱਦੇ ਨੂੰ ਕਿਵੇਂ ਹੱਲ ਕਰਦਾ ਹੈ ਸੁਣ ਕੇ ਪੰਜਾਬ ਵਿੱਚ ਖੇਡ ਖੇਤਰ ਖੇਡ ਖੇਤਰ ਇਸ ਤਰ੍ਹਾਂ ਸ ਸੱਟੇਬਾਜੀ ਜਾ ਜੂਏ ਦੇ ਮੁੱਦੇ ਨੂੰ ਹੱਲ ਕਰਦਾ ਹੈ ਲੋਕਾਂ ਨੂੰ ਵੱਧ ਤੋਂ ਵੱਧ ਗਾਈਡਾਂਸ ਦੇ ਕੇ ਹੋਰ ਖੇਡ ਕਿੱਤਿਆਂ ਦੇ ਵਿੱਚ ਭਗ ਭਾਗ ਲੈਣ ਲਈ ਅਤੇ ਹੈ ਰੋਕਥਾਮੀ ਹੈ ਕਿ ਆਪਾਂ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਸਮਝਾਉਣਾ ਚਾਹੀਦਾ ਕਿ ਸੱਟੇਬਾਜੀ ਜਾਂ ਜੂਏ ਦੇ ਜੂਏ ਜੂਆ ਨਹੀਂ ਖੇਡਣਾ ਚਾਹੀਦਾ ਇਸ ਨਾਲ ਬਹੁਤ ਸਾਰੇ ਲੋਕਾਂ ਦੇ ਘਰ ਤਬਾਹ ਹੋ ਜਾਂਦੇ ਹਾਂ ਇਹਨਾਂ ਨੂੰ ਇਹ ਚੀਜ਼ਾਂ ਨੂੰ ਰੋਕਣ ਲਈ ਲੋਕਾਂ ਲਈ ਐਕਟ ਚਲਾਉਣੇ ਚਾਹੀਦੇ ਹਨ ਕੁਝ ਕੁ ਪਾਰਟੀਆਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਨਿਯਮਾਂ ਨੂੰ ਲਾਗੂ ਵੀ ਕਰਨਾ ਚਾਹੀਦਾ ਹੈ ਤਾਂ ਜੋ ਸੱਟੇ ਜਾਂ ਜੂਏਬਾਜੀ ਦੀਆਂ ਚੀਜ਼ਾਂ ਨੂੰ ਰੋਕਿਆ ਜਾਵੇ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਮਝਾਇਆ ਜਾਵੇ ਕਿ ਇਹਨਾਂ ਇਹਨਾਂ ਚੀਜ਼ਾਂ ਇਹਨਾਂ ਚੀਜ਼ਾਂ ਵਿੱਚ ਕੋਈ ਫ਼ਾਇਦਾ ਨਹੀਂ ਮਿਹਨਤ ਕਰਨੀ ਚਾਹੀਦੀ ਹੈ ਅਤੇ ਇਹਨਾਂ ਚੀਜ਼ਾਂ ਨੂੰ ਪੰਜਾਬ ਦਾ ਖੇਡ ਖੇਤਰ ਹੀ ਰੋਕ ਸਕਦਾ ਹੈ ਬੱਚਿਆਂ ਬੱਚਿਆਂ ਨੂੰ ਵੱਧ ਤੋਂ ਵੱਧ ਹੋਰ ਖੇਤਰਾਂ ਦੇ ਵਿੱਚ ਗਾਈਡੈਂਸ ਕਰਨਾ ਚਾਹੀਦਾ ਵੀ ਤੁਸੀਂ ਇਸ ਖੇਤਰ ਇਹਨਾਂ ਖੇਡਾਂ ਵਿੱਚ ਪਾਰਟੀਸਪੇਟ ਕਰੋ ਤਾਂ ਜੋ ਬੱਚੇ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਅਤੇ ਆਪਣੇ ਆਪ ਨੂੰ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣ